ਮੇਰੀ ਮਨਪਸੰਦ ਖੇਡ ਬਾਸਕਿਟਬੋਲ ਹੈ ਅਤੇ ਇਸ ਖੇਡ ਨੂੰ ਮੈਂ ਆਪਣੀ ਅੱਠਵੀਂ ਜਮਾਤ ਤੋਂ ਖੇਡਦੀ ਆ ਰਹੀ ਹਾਂ ਇਸ ਖੇਡ ਨਾਲ਼ ਮੇਰੀਆਂ ਬਹੁਤ ਹੀ ਜ਼ਿਆਦਾ ਯਾਦਾਂ ਜੁੜੀਆਂ ਹਨ ਜਿਨ੍ਹਾਂ ਨੂੰ ਮੈਂ ਅੱਜ ਵੀ ਯਾਦ ਕਰਾਂ ਤਾਂ ਮੈਨੂੰ ਮਤਲਬ ਅਲੱਗ ਹੀ ਖੁਸ਼ੀ ਮਿਲਦੀ ਆ ਇਹਨਾਂ ਖੇਡਾਂ ਨਾਲ਼ ਮੇਰੀਆਂ ਕੁਝ ਅਜਿਹੀਆਂ ਯਾਦਾਂ ਜੁੜੀਆਂ ਹਨ ਕਿ ਮੈਂ ਉਸ ਪਲ ਨੂੰ ਕਦੀ ਭੁੱਲ ਨਹੀਂ ਸਕਦੀ ਮੈਂ ਫਸਟ ਟਾਈਮ ਆਪਣੇ ਬਾਸਕਿਟਬੋਲ ਦਾ ਸਟੇਟ ਲਗਾਉਣ ਗਈ ਸੀ ਟੈਂਥ 'ਚ ਉਦੋਂ ਮਤਲਬ ਸਾਡੇ ਸੀਨੀਅਰ ਦੀਦੀ ਸੀਗੇ ਅਤੇ ਉਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਗਾਈਡ ਕੀਤਾ ਸੀ ਕਿ ਹਾਂ ਤੁਸੀਂ ਕਰ ਸਕਦੇ ਹੋ ਬਾਕੀ ਸਾਨੂੰ ਆਪਣੇ ਆਪ 'ਤੇ ਵੈਸੇ ਇੰਨਾ ਕੌਨਫੀਡੈਂਸ ਨਹੀਂ ਸੀ ਪਰ ਆਪਾਂ ਉਹਨਾਂ ਦੀ ਗੱਲ ਮੰਨ ਕੇ ਅਤੇ ਉਹਨਾਂ ਨਾਲ਼ ਗਏ ਉਹਨਾਂ ਨੇ ਸਾਨੂੰ ਉੱਥੇ ਖੇਡਣ ਲਈ ਵੀ ਦਿੱਤਾ ਮੇਰੇ ਨਾਲ ਕੁਛ ਇੱਦਾਂ ਦੇ ਮਤਲਬ ਹਰਕਤ ਵੀ ਹੋਈ ਮੈਨੂੰ ਕੁਝ ਅਜੀਬ ਜਿਹਾ ਵੀ ਲੱਗਾ ਸੀਗਾ ਖੇਡ ਕੇ ਕਿ ਹਾਂ ਕਿ ਮੈਂ ਨਹੀਂ ਕਰ ਸਕਦੀ ਬਟ ਮੈਂ ਉਸ ਚੀਜ਼ ਨੂੰ ਕਰਕੇ ਦੱਸਿਆ ਜਦੋਂ ਆਪਾਂ ਫਸਟ ਟਾਈਮ ਸਟੇਟ ਗਏ ਸੀ ਹਾਂ ਉਸ ਟਾਈਮ ਮੈਂ ਖੇਡਦੇ ਖੇਡਦੇ ਡਿੱਗ ਵੀ ਗਈ ਸੀ ਮੇਰੇ ਸੱਟ ਵੀ ਲੱਗੀ ਸੀ ਬਟ ਮੈਂ ਮਤਲਬ ਕੁਝ ਸੋਚਿਆ ਨਹੀਂ ਜ਼ਿਆਦਾ ਉਹਦੇ ਬਾਰੇ ਔਰ ਮੈਂ ਉੱਠ ਕੇ ਫੇਰ ਖੇਡਣ ਲੱਗ ਪਈ ਬਾਕੀ ਇੱਦਾਂ ਦੀਆਂ ਕੁਝ ਹੋਰ ਵੀ ਯਾਦਾਂ ਨੇ ਜਿਨ੍ਹਾਂ ਨੂੰ ਮੈਂ ਅੱਜ ਵੀ ਯਾਦ ਕਰਕੇ ਮਤਲਬ ਉਹ ਪਲ ਅੱਜ ਵੀ ਯਾਦ ਕਰਕੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹਾਂ ਅਤੇ ਹੁਣ ਮੈਨੂੰ ਉਹ ਚੀਜ਼ ਦੁਬਾਰਾ ਕਰਨ ਨੂੰ ਨਹੀਂ ਮਿਲਦੀ ਸਕੂਲ ਟਾਈਮ ਸੀਗਾ ਜਦ ਆਪਾਂ ਖੇਡ ਲੈਂਦੇ ਸੀ ਪਰ ਕੋਲੇਜ ਲਾਈਫ 'ਚ ਉਹ ਚੀਜ਼ ਨਹੀਂ ਆ ਮੈਂ ਆਪਣਾ ਲਾਸਟ ਸਟੇਟ ਲਗਾ ਕੇ ਆਈ ਸੀ ਪਟਿਆਲਾ ਔਰ ਉੱਥੇ ਵੀ ਮਤਲਬ ਆਪਾਂ ਬਹੁਤ ਸਾਰਾ ਇੰਜੋਏ ਕੀਤਾ ਸੀ ਸਟੇਟ ਖੇਡੇ ਵੀ ਸੀ ਇੰਜੋਏ ਵੀ ਕੀਤਾ ਸੀ ਮਤਲਬ ਉਹ ਦਿਨ ਅਜੇ ਤੱਕ ਮੈਨੂੰ ਯਾਦ ਨੇ ਆਪਣੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ